ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਰਾਜੇ ਪੈਦਾ ਹੋਏ ਹਨ ਜਿਹਨਾਂ ਬਾਰੇ ਲੋਕ ਬੱਚੇ ਪੜ੍ਹਦੇ ਰਹਿੰਦੇ ਹਨ ਜਿਹਨਾਂ ਵਿੱਚੋਂ ਇੱਕ ਮਹਾਰਾਜਾ ਰਣਜੀਤ ਸਿੰਘ ਜੋ ਕਿ ਸ਼ੁਕਰ ਚੱਕੀਆ ਮਿਸਲ ਦੇ ਰਾਜਾ ਸਨ ਉਹਨਾਂ ਨੇ ਸਿੱਖ ਧਰਮ ਨੂੰ ਉੱਪਰ ਚੁੱਕਣ ਵਾਸਤੇ ਬਹੁਤ ਹੀ ਲੜਾਈਆਂ ਲੜੀਆਂ ਅਤੇ ਉਹਨਾਂ ਦੇ ਰਾਜ ਕਾਲ ਸਮੇਂ ਪਰਜਾ ਬਹੁਤ ਸੁਖੀ ਸੀ ਜੋ ਵੀ ਇਕ ਪਰਉਪਕਾਰੀ ਰਾਜੇ ਦਾ ਫਰਜ਼ ਬਣਦਾ ਹੈ ਉਹ ਉਸ ਨੇ ਉਹਨੂੰ ਅਪਣਾਇਆ ਦੂਸਰਾ ਆਪਣੇ ਧਰਮ ਦੀ ਖਾਤਰ ਆਪਣੇ ਰਾਜ ਦੀ ਖਾਤਰ ਹਿੰਦੁਸਤਾਨ ਦੇ ਖਾਤਰ ਉਸਨੇ ਬਹੁਤ ਲੜਾਈਆਂ ਲੜੀਆਂ ਔਰ ਜ਼ਿਆਦਾਤਰ ਅਫਗਾਨਾ ਨਾਲ ਕੋਹੀਨੂਰ ਹੀਰਾ ਕਲੈਕਟ ਕਰਨ ਵਾਸਤੇ ਲੈਣ ਵਾਸਤੇ ਉਹਨਾਂ ਤੋਂ ਬਹੁਤ ਹੀ ਸਾਜਿਸ਼ਾਂ ਰਚੀਆਂ ਜਿਹਨਾਂ ਵਿੱਚ ਉਹਨਾਂ ਨੇ ਅਫਗਾਨ ਦੇ ਜੰਗਲਾਂ ਵਿੱਚ ਕੋਹੀਨੂਰ ਹੀਰਾ ਲੈ ਕੇ ਛੁਪਣ ਤੋਂ ਬਾਅਦ ਉਹਨਾਂ ਦੀ ਭਾਲ ਸ਼ੁਰੂ ਕੀਤੀ ਖੁਫੀਆ ਛੱਡੇ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਜਦ ਇਸ ਦੀ ਬਹੁਤ ਜ਼ਿਆਦਾ ਘਾਲਣਾ ਘਾਲੀ ਜਿਸ ਕਰਕੇ ਉਹਨਾਂ ਨੇ ਕੋਹੀਨੂਰ ਹੀਰਾ ਪ੍ਰਾਪਤ ਕੀਤਾ ਹੁਣ ਤੱਕ ਵੀ ਬੱਚੇ ਉਹਨਾਂ ਦੀ ਯਾਦ ਵਿੱਚ ਬਹੁਤ ਕਿਤਾਬਾਂ ਪੜ੍ਹਦੇ ਹਨ ਉਹਨਾਂ ਦੀਆਂ ਹਿਸਟਰੀਆਂ ਪੜ੍ਹਦੇ ਹਨ ਉਹਨਾਂ ਦੇ ਰਾਜ ਬਾਰੇ ਗਿਆਨ ਕਰ ਪ੍ਰਾਪਤ ਕਰਦੇ ਹਨ ਤਾਂ ਬਹੁਤ ਹੀ ਚੰਗਾ ਲੱਗਦਾ ਹੈ